ਮੈਂ ਕੁਦਰਤ ਵੱਲੋਂ ਬਣਾਏ ਪੰਛੀਆਂ ਨੂੰ ਦੇਖਣ ਦਾ ਬਹੁਤ ਸ਼ੌਕੀਨ ਹਾਂ ਅਤੇ ਜਿਹੜੇ ਕਿ ਦੁਰਲਭ ਪੰਛੀ ਜਿਹੜੇ ਕਿਸੇ ਨੇ ਦੇਖੇ ਨਹੀਂ ਹੁੰਦੇ ਉਹਨਾਂ ਨੂੰ ਦੇਖਣ ਦਾ ਤੇ ਹੋਰ ਸ਼ੌਕੀਨ ਹਾਂ ਲਾਲ ਸਿਰ ਵਾਲਾ ਗਿਧ ਜੰਗਲੀ ਉੱਲੂ ਟਟਿਹਰੀ ਬਸਟਰ ਫੈਮਲੀ ਗਰੇਟ ਇੰਡੀਅਨ ਬਸਟਰ ਪੰਛੀ ਦੁਰਲੱਭ ਪੰਛੀਆਂ ਵਿੱਚੋਂ ਇੱਕ ਹੈ ਇਸ ਨੂੰ ਸੌਣ ਚਿੜੀਆ ਵੀ ਕਿਹਾ ਜਾਂਦਾ ਹੈ ਇਹ ਜਮੀਨ ਤੋਂ ਇਕ ਮੀਟਰ ਉੱਚਾ ਹੁੰਦਾ ਹੈ ਇਸ ਪੰਛੀ ਦਾ ਬਹੁਤ ਜਿਆਦਾ ਸ਼ਿਕਾਰ ਹੋਣ ਕਰਕੇ ਇਹ ਦਾ ਕਾਫੀ ਸ਼ਹਿਰਾਂ ਵਿੱਚ ਖਾਤਮਾ ਹੋ ਰਹਾ ਇਹ ਰਾਜਸਥਾਨ ਰਾਜ ਦਾ ਪੰਛੀ ਹੈ ਇਹ ਮਹਾਰਾਸ਼ਟਰ ਤੇ ਸ਼ੋਲਾਪੁਰ ਗਰੇਡ ਇੰਡੀਅਨ ਵਸਟਰ ਸੈਂਚਰੀ ਨਾਮ ਦੇ ਇਲਾਕੇ ਚ ਮਿਲਦਾ ਹੈ ਅਤੇ ਜਦੋਂ ਇਹ ਨਜ਼ਰ ਆਉਂਦਾ ਹੈ ਤਾਂ ਮਨ ਇੰਨਾ ਖੁਸ਼ ਹੁੰਦਾ ਹੈ ਕਿ ਬਸ ਇਹਨਾਂ ਨੂੰ ਦੇਖਦਾ ਹੀ ਰਵਾਂ ਅਤੇ ਇਹਨਾਂ ਦਾ ਆਨੰਦ ਮਾਣ ਲਵਾਂ ਤੇ ਫਿਰ ਇਹਨੂੰ ਆਪਣੇ ਫੋਨ 'ਚ ਫੋਟੋ ਕਲਿਕ ਕਰਕੇ ਸੇਵ ਕਰ ਸਕਾਂ ਬਸ ਇਹੀ ਕੁਦਰਤੀ ਨਜ਼ਾਰਾ ਮੈਂ ਦੇਖਣ ਦਾ ਸ਼ੌਕੀਨ ਹਾਂ ਅਤੇ ਦੁਰਲੱਭ ਪੰਛੀਆਂ ਦਾ ਦੇਖਣ ਦਾ ਸ਼ੌਕੀਨ ਮੈਂ ਬਹੁਤ ਜਿਆਦਾ ਹਾਂ